ਆਮ ਗਾਰਡਨਿੰਗ ਜੋ ਹੈ ਉਹ ਧਰਤੀ ਦੇ ਉੱਤੇ ਆਪਾਂ ਕਰ ਸਕਦੇ ਹਾਂ ਜੇਕਰ ਆਪਣੇ ਕੋਲ ਗਾਰਡਿੰਗ ਲਈ ਬਾਹਰ ਜਗ੍ਹਾ ਨਹੀਂ ਹੈ ਤਾਂ ਆਪਾਂ ਟੈਰਿਸ ਦੇ ਉੱਤੇ ਵੀ ਗ੍ਰੋਅ ਬੈਗ ਰੱਖ ਕੇ ਗਾਰਡਨਿੰਗ ਕਰ ਸਕਦੇ ਹਾਂ ਜੋ ਕਿ ਅਸੀਂ ਕੀਤੀ ਹੋਈ ਹੈ